ਮੇਰਾ ਨਾਮ ਮਮਤਾ ਦੇਵੀ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੈਂ ਰੋਜ਼ ਸਵੇਰੇ ਉੱਠ ਕੇ ਯੋਗਾ ਕਰਦੀ ਹਾਂ ਜੇ ਮੈਂ ਗੱਲ ਕਰਾਂ ਕਿ ਯੋਗੇ ਦੇ ਕੀ ਫਾਇਦੇ ਹਨ ਯੋਗਾ ਤਾਂ ਸਭ ਤੋਂ ਵੱਡਾ ਫਾਇਦਾ ਹੈ ਕਿ ਇਹ ਸਾਡੇ ਸਰੀਰ ਨੂੰ ਤਾਕਤਵਰ ਤੇ ਅਤੇ ਤੰਦੁਰਸਤ ਬਣਾਉਂਦਾ ਹੈ ਜੋ ਬੰਦਾ ਯੋਗਾ ਕਰਦਾ ਉਸਨੂੰ ਬਿਮਾਰੀਆਂ ਦਾ ਖਤਰਾ ਬਹੁਤ ਘੱਟ ਹੁੰਦਾ ਹੈ ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ ਯੋਗੇ ਦੇ ਨਾਲ ਅਸੀਂ ਕਈ ਬਿਮਾਰੀਆਂ ਨੂੰ ਦੂਰ ਭਜਾ ਸਕਦੇ ਹਾਂ ਜੀ ਠੀਕ ਕਰ ਸਕਦੇ ਹਾਂ ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਯੋਗਾ ਸੈਂਟਰ ਵੀ ਹਨ ਜਿੱਥੇ ਹਫਤੇ ਵਿੱਚ ਅਸੀਂ ਕਦੀ ਕਦੀ ਯੋਗਾ ਕਰਨ ਜਾਂਦੇ ਹਾਂ ਜੋ ਕਿ ਮੁਫਤ ਹੈ ਸਾਡੇ ਜ਼ਿਲ੍ਹੇ ਵਿੱਚ ਕਈ ਪਾਰਕ ਵੀ ਹਨ ਜਿੱਥੇ ਅਸੀਂ ਸਵੇਰੇ ਤੜਕੇ ਸਾਰ ਯੋਗ ਕਰਨ ਜਾਂਦੇ ਹਾਂ ਯੋਗਾ ਕਰਦੇ ਸਮੇਂ ਅਸੀਂ ਨਾਲ ਇੱਕ ਛੋਟਾ ਜਿਹਾ ਸਪੀਕਰ ਵੀ ਰੱਖਿਆ ਹੁੰਦਾ ਹੈ ਜਿਸ ਵਿੱਚ ਅਸੀਂ ਯੋਗੇ ਦੇ ਗੀਤ ਲਗਾਏ ਹੁੰਦੇ ਹਨ ਅਤੇ ਕਦੀ ਕਦੀ ਅਸੀਂ ਟੀ ਵੀ ਵਿੱਚ ਵੀ ਬਾਬਾ ਰਾਮਦੇਵ ਜੀ ਦਾ ਯੋਗ ਦੇਖਦੇ ਹਾਂ ਅਤੇ ਨਾਲ ਉੱਥੇ ਅਸੀਂ ਨਵੇਂ ਨਵੇਂ ਯੋਗਾ ਆਸਣ ਸਿੱਖਦੇ ਹਾਂ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਅਸੀਂ ਇਹ ਵੀ ਦੇਖਦੇ ਹਾਂ ਕਿ ਬਾਬਾ ਰਾਮਦੇਵ ਜੀ ਨੇ ਅੱਜ ਤੱਕ ਕਈ ਮਰੀਜ਼ਾਂ ਨੂੰ ਯੋਗ ਦੇ ਨਾਲ ਹੀ ਠੀਕ ਕਰ ਦਿੱਤਾ ਹੈ ਇਹ ਦੇਖ ਕੇ ਸਾਡੇ ਅੰਦਰ ਵੀ ਯੋਗ ਕਰਨ ਦੀ ਭਾਵਨਾ ਜਾਗ ਹੁੰਦੀ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਅੱਜ ਕੱਲ ਅਸੀਂ ਵੇਖਦੇ ਹਾਂ ਕਿ ਜਿਨ੍ਹਾਂ ਦਾ ਭਾਰ ਵਧਿਆ ਹੋਵੇ ਉਹ ਯੋਗ ਦੇ ਨਾਲ ਆਪਣਾ ਭਾਰ ਬਹੁਤ ਹੀ ਸੇਟਤੀ ਘਟਾ ਸਕਦੇ ਹਨ ਇਸ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਦੱਸ ਦੇਵਾਂ ਕਿ ਜਿੱਦਾਂ ਦੀਆਂ ਦਵਾਈਆਂ ਦੇ ਕਾਫੀ ਨੁਕਸਾਨ ਹੁੰਦੇ ਹਨ ਯੋਗਾ ਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ ਨਾਲ ਅਤੇ ਯੋਗ ਕਰਨ ਦੇ ਨਾਲ ਸਾਨੂੰ ਸਾਹ ਦੀ ਬਿਮਾਰੀ ਨਹੀਂ ਲੱਗਦੀ ਅਤੇ ਅੰਤ ਵਿੱਚ ਮੈਂ ਇਹ ਕਹਿਣਾ ਚਾਹਵਾਂਗੀ ਕਿ ਸਾਨੂੰ ਸਾਰਿਆਂ ਨੂੰ ਹਰ ਰੋਜ਼ ਕੁਝ ਟਾਈਮ ਕੱਢ ਕੇ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ ਜੋ ਸਾਡੇ ਲਈ ਫਾਇਦੇਮੰਦ ਹੈ ਧੰਨਵਾਦ